ਚਿੱਤਰਕਾਰੀ ਨੂੰ ਇੱਕ ਪੇਸ਼ੇ ਵਜੋਂ ਲੈਣਾ ਬਹੁਤ ਵਧੀਆ ਗੱਲ ਹੈ ਚਿੱਤਰਕਾਰੀ ਵਿੱਚ ਸਾਨੂੰ ਬਹੁਤ ਵਧੀਆ ਇਨਕਮ ਮਿਲ ਜਾਂਦੀ ਹੈ ਚਿੱਤਰਕਾਰੀ ਵਿੱਚ ਚਿੱਤਰਕਾਰ ਨੂੰ ਆਪਣੀਆਂ ਬਣਾਉਣ ਵਾਲੀਆਂ ਚੀਜ਼ਾਂ ਉੱਪਰ ਪੂਰਾ ਧਿਆਨ ਰੱਖਣਾ ਰੱਖ ਕੇ ਚਿੱਤਰ ਬਣਾਉਣਾ ਪੈਂਦਾ ਹੈ ਚਿੱਤਰਕਾਰ ਵੱਲੋਂ ਬਣਾਈ ਹੋਏ ਚਿੱਤਰ ਦੀ ਕੀਮਤ ਬਹੁਤ ਵਧੀਆ ਲੱਗ ਜਾਂਦੀ ਹੈ ਚਿੱਤਰਕਾਰੀ ਇੱਕ ਬਹੁਤ ਵਧੀਆ ਕਲਾ ਹੈ ਜਿਸ ਨੂੰ ਸਾਡੇ ਕੋਲੋਂ ਕੋਈ ਨਹੀਂ ਖੋਹ ਸਕਦਾ ਚਿੱਤਰਕਾਰ ਵੱਲੋਂ ਬਣਾਏ ਚਿੱਤਰਾਂ ਦੀ ਨਿਲਾਮੀ ਵੀ ਹੁੰਦੀ ਹੈ ਕੁਝ ਚਿੱਤਰ ਬਹੁਤ ਵਧੀਆ ਕੀਮਤ 'ਤੇ ਵਿੱਕ ਜਾਂਦੇ ਹਨ ਅਤੇ ਕੁਝ ਦੀ ਕੀਮਤ ਨਾ ਵਧੀਆ ਹੋਣ ਕਰਕੇ ਚਿੱਤਰਕਾਰ ਉਸ ਨੂੰ ਨਹੀਂ ਵੇਚ ਪਾਉਂਦਾ ਧੰਨਵਾਦ